ਪੰਜਾਬ ਵਿੱਚ ਕਈ ਕਾਰੋਬਾਰ ਹਨ ਜੋ ਅੰਤਰਾਸ਼ਟਰੀ ਪੱਧਰ ਤੱਕ ਛਾਏ ਹੋਏ ਹਨ ਜਿਵੇਂ ਕਿ ਪਹਿਲਾ ਖੇਤੀਬਾੜੀ ਅਤੇ ਫਾਰਮਿਕ ਉਤਪਾਤ ਪੰਜਾਬ ਦੀ ਖੇਤੀਬਾੜੀ ਅਤੇ ਖ਼ਾਸ ਕਰਕੇ ਗੇਹੂੰ ਚੌਲ ਅਤੇ ਦੁੱਧ ਦੇ ਉਤਪਾਤ ਅੰਤਰਰਾਸ਼ਟਰੀ ਮਾਰਕੀਟਾਂ ਵਿੱਚ ਜਾਣੇ ਜਾਂਦੇ ਹਨ ਕੱਪੜੇ ਅਤੇ ਟੈਕਸਟਾਈਲ ਪੰਜਾਬ ਵਿੱਚ ਫੈਸ਼ਨ ਅਤੇ ਟੈਕਸਟਾਈਲ ਉਤਪਾਤ ਵੀ ਅੰਤਰਾਸ਼ਟਰੀ ਤੌਰ 'ਤੇ ਰੱਖਦੇ ਹਨ ਸਪੋਟਸ ਗੂੱਡਜ ਜਲੰਧਰ ਅਤੇ ਹੋਰ ਖੇਤਰਾਂ ਵਿੱਚ ਖੇਡ ਉਤਪਾਤ ਜਿਵੇਂ ਕਿ ਕ੍ਰਿਕਟ ਬੱਲਾ ਹਾਕੀ ਵਿਸ਼ਵ ਪੱਧਰ 'ਤੇ ਮਸ਼ਹੂਰ ਹਨ ਜਿਵੇਂ ਕਿ ਭੰਗੜਾ ਵੀ ਇੱਕ ਅਜਿਹਾ ਕਾਰੋਬਾਰ ਜਾਂ ਸੱਭਿਆਚਾਰ ਹੈ ਜੋ ਕਿ ਬਹੁਤ ਵਲਡਵਾਈਡ ਫੇਮਸ ਹੈ ਪੰ ਪੰਜਾਬ ਦੇ ਕਾਰੋਬਾਰਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪਹੁੰਚਾਉਣ ਲਈ ਕੁਝ ਟਿਪਸ ਹਨ ਜਿਵੇਂ ਕਿ ਗੁਣਵੱਤਾ 'ਤੇ ਜ਼ੋਰ ਉਤਪਾਦਾਂ ਦੀ ਗੁਣਵੱਤਾ ਉੱਤਮ ਹੋਣੀ ਚਾਹੀਦੀ ਹੈ ਕਿ ਉਹ ਵਿਸ਼ਵ ਵਿਸ਼ਗੋਨਸ ਹੋ ਸਕਣ ਨਵੀਨਤਾ ਅਤੇ ਤਕਨੀਕੀ ਅਪਨਾਉਣ ਧੰਨਵਾਦ ਜੀ